ਹਾਂਜੀ ਮੈਨੂੰ ਬਚਪਨ ਵਿੱਚ ਪਹਾੜਾਂ ਅਤੇ ਉੱਚਾਈਆਂ ਤੋਂ ਡਰ ਲੱਗਦਾ ਸੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਅਤੇ ਮੈਂ ਵੱਡਾ ਹੋਇਆ ਮੇਰਾ ਇਹ ਡਰ ਦੂਰ ਹੋ ਗਿਆ ਇਸ ਦਾ ਮੁੱਖ ਕਾਰਣ ਮੇਰੇ ਵੱਲੋਂ ਮੈਡੀਟੇਸ਼ਨ ਕਰਨਾ ਅਤੇ ਯੋਗਾ ਕਰਨਾ ਵੀ ਹੈ ਇਸ ਤੋਂ ਇਲਾਵਾ ਮੇਰੀ ਸਰੀਰਕ ਸਮਰੱਥਾ ਵੀ ਵੱਧ ਗਈ ਹੈ ਬਚਪਨ ਵਿੱਚ ਮੈਂ ਉੱਚਾਈ ਜਾ ਪਹਾੜਾਂ ਦਾ ਸਫਰ ਕਰਨ ਵੇਲੇ ਬੱਸਾਂ ਵਿੱਚ ਉਲਟੀ ਅਤੇ ਘਬਰਾਹਟ ਦੀ ਸਮੱਸਿਆ ਨਾਲ ਜੂਝਦਾ ਰਹਿੰਦਾ ਸੀ ਪਰੰਤੂ ਹੁਣ ਮੈਨੂੰ ਇੱਦਾਂ ਦੀ ਕੋਈ ਵੀ ਸਮੱਸਿਆ ਨਹੀਂ ਹੈ ਅਤੇ ਮੈਂ ਪਿਛਲੇ ਕੁਝ ਸਾਲਾਂ ਵਿੱਚ ਇੱਕ ਦੋ ਟੂਰ ਲਗਾਏ ਹਨ ਅਤੇ ਇਹਨਾਂ ਵਿੱਚ ਪਹਾੜਾਂ ਦੀ ਸੈਰ ਕਰਨ ਵੇਲੇ ਮੈਨੂੰ ਕੋਈ ਵੀ ਸਮੱਸਿਆ ਜਾਂ ਸ਼ਿਕਾਇਤ ਦਾ ਸਾਹਮਣਾ ਨਹੀਂ ਕਰਨਾ ਪਿਆ